ਭਾਰਤ ਵਿੱਚ ਸਭ ਨੂੰ ਚਾਹ ਬਹੁਤ ਪਸੰਦ ਹੈ ਸਾਰੇ ਚਾਹ ਬਹੁਤ ਚਾਅ ਨਾਲ ਪੀਂਦੇ ਹਨ ਚਾਹ ਨੂੰ ਕਈ ਕਈ ਟਾਈਮ ਪੀਂਦੇ ਹਨ ਤਾਂ ਜੋ ਸਾਡੀ ਸੁਸਤੀ ਹਟ ਜਾਵੇ ਘਰ ਆਏ ਪਰਾਹੁਣੇ ਲਈ ਵੀ ਚਾਹ ਪੀਤੀ ਜਾਂਦੀ ਹੈ ਜਾਂ ਦਿੱਤੀ ਜਾਂਦੀ ਹੈ ਘਰ ਆਏ ਪਰਾਹੁਣੇ ਲਈ ਚਾਹ ਨਾਲ ਪਕੌੜੇ ਬਰਫੀ ਅਤੇ ਸਮੋਸੇ ਵੀ ਦਿੱਤੇ ਜਾਂਦੇ ਹਨ ਚਾਹ ਕਈ ਤਰੀਕੇ ਨਾਲ ਦਿੱਤੀ ਜਾਂਦੀ ਹੈ ਚਾਹ ਨੂੰ ਬਣਾਉਣ ਲਈ ਇੱਕ ਖੁੱਲ੍ਹੇ ਅਤੇ ਵੱਡੇ ਭਾਂਡੇ ਦੀ ਜ਼ਰੂਰਤ ਪੈਂਦੀ ਹੈ ਖੁੱਲ੍ਹੇ ਅਤੇ ਵੱਡੇ ਭਾਂਡੇ ਨੂੰ ਗੈਸ ਉੱਤੇ ਰੱਖ ਕੇ ਉਸ ਵਿੱਚ ਇੱਕ ਕੱਪ ਪਾਣੀ ਪਾ ਕੇ ਅਤੇ ਉਸ ਵਿੱਚ ਪੱਤੀ ਪਾ ਦਿੱਤੀ ਜਾਂਦੀ ਹੈ ਪੱਤੀ ਤੋਂ ਬਾਅਦ ਉਸ ਵਿੱਚ ਸੌਂਫ ਅਦਰਕ ਜਾਂ ਅਜਵੈਣ ਵੀ ਪਾ ਸਕਦੇ ਹਾਂ ਲੌਂਗ ਜਾਂ ਸੁੰਡ ਇਲਾਚੀਆਂ ਵੀ ਪਾ ਸਕਦੇ ਹਾਂ ਉਸ ਉਹ ਤੁਸੀਂ ਆਪਣੇ ਤਰੀਕੇ ਨਾਲ ਬਣਾ ਸਕਦੇ ਹੋ ਕਿ ਕੀ ਕੀ ਪਾਉਣਾ ਹੈ ਅਤੇ ਫੇਰ ਉਸ ਵਿੱਚ ਖੰਡ ਵੀ ਪਾ ਦਿੱਤੀ ਜਾਂਦੀ ਹੈ ਖੰਡ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਰਿੱਝਣ ਦਿੱਤਾ ਜਾਂਦਾ ਹੈ ਰਿੱਝਣ ਤੋਂ ਬਾਅਦ ਉਸ ਵਿੱਚ ਇੱਕ ਕੱਪ ਹੋਰ ਦੁੱਧ ਦਾ ਪਾ ਦਿੱਤਾ ਜਾਂਦਾ ਹੈ ਦੁੱਧ ਪਾਉਣ ਤੋਂ ਬਾਅਦ ਉਸਨੂੰ ਫਿਰ ਚੰਗੀ ਤਰ੍ਹਾਂ ਰਿੱਝਾ ਕੇ ਚਾਹ ਬਣ ਜਾਂਦੀ ਹੈ ਚਾਹ ਬਹੁਤ ਟੇਸਟ ਅਤੇ ਸੁਸਤੀ ਦੂਰ ਕਰਦੀ ਹੈ ਇਸ ਕਰਕੇ ਘਰ ਆਏ ਪਰਾਹੁਣੇ ਚਾਹ ਨੂੰ ਬਹੁਤ ਪਸੰਦ ਕਰਦੇ ਹਨ ਕੌਫੀ ਅਤੇ ਚਾਹ ਵਿੱਚੋਂ ਜੇ ਕਿਸੇ ਨੇ ਪਰਾਹੁਣੇ ਨੂੰ ਚਾਹ ਵੱਲੋਂ ਕਹਿ ਦਿੱਤਾ ਜਾਵੇ ਤਾਂ ਉਹ ਬਹੁਤ ਖੁਸ਼ ਹੋ ਜਾਂਦੇ ਹਨ ਭਾਰਤ ਵਿੱਚ ਚਾਹ ਸਭ ਤੋਂ ਜ਼ਿਆਦਾ ਹੀ ਪੀਤੀ ਜਾਂਦੀ ਹੈ ਕੌਫੀ ਨਾਲੋਂ ਜ਼ਿਆਦਾ ਵੀ ਚਾਹ ਨੂੰ ਪਸੰਦ ਕੀਤਾ ਜਾਂਦਾ ਹੈ ਧੰਨਵਾਦ